ਅਸੀਂ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ ਰੱਖਣ ਲਈ ਕਈ ਤਰੀਕੇ ਦੇ ਉਪਾਅ ਕਰ ਸਕਦੇ ਹਾਂ ਜਿਸ ਦੇ ਲਈ ਮੈਂ ਤੁਹਾਡੇ ਨਾਲ ਉਪਾਅ ਸਾਂਝੇ ਕਰ ਰਿਹਾ ਹਾਂ ਜਿਵੇਂ ਕਿ ਅਸੀਂ ਗਲੀ ਦੀ ਸਾਫ ਸਫਾਈ ਆਪਣੇ ਪੱਧਰ 'ਤੇ ਕਰਵਾ ਸਕਦੇ ਹਾਂ ਅਤੇ ਇਸ ਦੇ ਲਈ ਮਿਊਸੀਪਲ ਕੌਂਸਲ ਦਾ ਸਟਾਫ ਵੀ ਕੰਮ ਕਰ ਰਿਹਾ ਹੈ ਜਿਸ ਦੇ ਵਿੱਚ ਕਾਫੀ ਵਰਕਰ ਕੰਮ ਕਰਦੇ ਹਨ ਜੋ ਕਿ ਅਲੱਗ ਅਲੱਗ ਵਾਰਡਾਂ ਵਿੱਚ ਜਾਂਦੇ ਹਨ ਅਤੇ ਕੂੜਾ ਚੁੱਕਦੇ ਹਨ ਉਹਨਾਂ ਵੱਲੋਂ ਘਰਾਂ ਵਿੱਚ ਹੀ ਘਰਾਂ ਵਿੱਚੋਂ ਹੀ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਉਸਨੂੰ ਪ੍ਰੋਸੈਸ ਕਰਨ ਦੇ ਲਈ ਉਹ ਆਪਣੇ ਅ ਕੂੜੇ ਨੂੰ ਐਮ ਆਰ ਐਫ ਸ਼ੈਡ ਸ਼ ਸੈਂਟਰਾਂ ਉੱਪਰ ਲੈ ਕੇ ਜਾਂਦੇ ਹਨ ਜਿੱਥੇ ਕੂੜੇ ਨੂੰ ਅਲੱਗ ਅਲੱਗ ਅਲੱਗ ਅਲੱਗ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਅਤੇ ਉਸਨੂੰ ਬੋਰਿਆਂ ਵਿੱਚ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਕੂੜੇ ਨੂੰ ਉਹ ਪ੍ਰੋਸੈਸ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਦੀ ਸਾਫ ਸਫਾਈ ਲਈ ਕੋਈ ਫਲਦਾਰ ਫੁੱਲਦਾਰ ਬੂਟੇ ਲਗਾ ਸਕਦੇ ਹਾਂ ਜਿਸ ਦੇ ਨਾਲ ਗਲੀ ਵੀ ਗਲੀ ਦਾ ਆਲਾ ਦੁਆਲਾ ਵੀ ਚਮਕੇਗਾ ਅਤੇ ਹਰਿਆਲੀ ਦਿਖਾਈ ਦੇਵੇਗੀ